ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲ ਜੂਗੀ ਉਹਦਾ ਇੱਕ ਸੌ ਚਾਲੀ ਰੁਪਏ ਪ੍ਰਿੰਟ ਕਾਸ਼ ਦਮਨ ਮਿਲ ਜੂਗੀ ਉਹਦਾ ਅੱਸੀ ਰੁਪਏ ਉਨ੍ਹਾਂ ਨੂੰ ਜਿਵੇਂ ਮਹਾਂ ਮਹਾਂ ਯੋਗ ਗੂਗਲ ਆ ਆਉਂਦਾ ਉਹ ਦੇ ਸਕਦੇ ਹਾਂ ਨਾਲ ਰੀਮੋ ਪ੍ਰਵਾਈ ਪੀਣ ਵਾਸਤੇ ਆਉਂਦੀ ਆ ਉਹ ਵੀ ਦੇ ਸਕਦੇ ਜੋੜਾਂ ਦੇ ਦਰਦ ਵਾਸਤੇ ਨਹੀਂ ਐਤਵਾਰ ਨੂੰ ਕਲੋਜ਼ ਹੁੰਦੀ ਆ ਬਾਕੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ੋਪ ਖੁੱਲ੍ਹੀ ਹੁੰਦੀ ਆ ਹਾਂ ਉਹ ਜਿਵੇਂ ਦਸਾਂਦਾ ਆਉਂਦਾ ਉਬਾਲ ਕੇ ਲੈਣ ਵਾਸਤੇ ਉਹ ਚੀਜ਼ਾਂ ਮਲੱਠੀ ਆਉਂਦੀ ਆ ਮਨਾਕਸ਼ਾਂ ਹੁੰਦੀਆਂ ਛੋਟੀ ਇਲੈਚੀ ਆ ਸੌਂਫ ਆ ਮਨੱਕਾ ਉਹ ਦਸਾਂਦਾ ਬਣਾ ਕੇ ਦੇਈ ਦਾ ਵਾ ਅਤੇ ਉਹਨੂੰ ਉਬਾਲ ਕੇ ਲੈਣਾ ਅਤੇ ਉਹਦੇ ਨਾਲ ਖੰਘ ਜ਼ੁਕਾਮ ਜੋ ਵੀ ਅੱਜ ਕੱਲ੍ਹ ਮੌਸਮ ਦੇ ਨਾਲ ਹੁੰਦਾ ਉਹ ਠੀਕ ਹੋ ਜਾਂਦਾ ਹਾਂ ਉਹਨਾਂ ਨੂੰ ਜਿਵੇਂ ਅਸ਼ੋਕਾ ਰਿਸ਼ਟ ਪੀਣ ਵਾਲੀ ਆਉਂਦੀ ਆ ਉਹ ਇੱਕ ਵੈਦਨਾਥ ਦੀ ਚੰਦਨ ਪ੍ਰੋ ਬੱਟੀ ਆ ਟੈਬਲੇਟ ਖਾਣ ਵਾਸਤੇ ਨਾਲ ਉਹ ਦਿਓਂਗੇ ਤਾਂ ਇਹ ਸਮੱਸਿਆ ਬਿਲਕੁਲ ਠੀਕ ਹੋਊ ਪਰ ਉਹਨੂੰ ਦੋ ਮਹੀਨੇ ਖਾਣੀ ਪੈਣੀ ਹਾਂਜੀ ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ ਦਸ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਆ ਸਕਦੇ ਹਾਂ ਉਹ ਹਫ਼ਤੇ ਦੀ ਦਵਾਈ ਤਿੰਨ ਕੁ ਸੌ ਰੁਪਏ ਹਫ਼ਤੇ ਦੀ ਹੋਊਗੀ ਅਤੇ ਉਹ ਲਗਾਤਾਰ ਖਾਣੀ ਪਊਗੀ ਅਤੇ ਬਿਲਕੁਲ ਪ੍ਰੋਬਲਮ ਸੋਲਵ ਹੋਜੂ ਉਹਦੇ ਨਾਲ ਟਾਈਫਾਈਡ ਦਾ ਤਾਂ ਤੁਸੀਂ ਦਸਾਂਦਾ ਲੈ ਲਓਂਗੇ ਬਾਕੀ ਕਾਸ਼ ਦਮਨ ਪੀਣ ਵਾਸਤੇ ਲੈ ਲਓਂਗੇ ਨਾਲ ਅਤੇ ਨਾਲ ਆਪਣੀ ਚਿਤ੍ਰਕਾ ਬੱਟੀ ਆਉਂਦੀ ਹੈਗੀ ਆ ਟੈਬਲੇਟ ਵੈਦਨਾਥ ਦੀ ਨਾਲ ਉਹ ਖਾਣੀ ਪਊਗੀ ਅਤੇ ਉਹਦੇ ਨਾਲ ਟਾਈਫਾਈਡ ਵੀ ਠੀਕ ਹੋਜੂ